ਜਿੱਦਾਂ ਹੁਣ ਡਰਾਇੰਗ ਕਰਦੇ ਹਾਂ ਡਰਾਇੰਗ ਨੂੰ ਇੱਕ ਵਧੀਆ ਤਰੀਕੇ ਨਾਲ ਬਣਾਉਣਾ ਜਿਵੇਂ ਸਾਡੇ ਉਹਦੇ ਵਿੱਚ ਇੱਕ ਡਰਾਫਟਿੰਗ ਹੁੰਦੀ ਹੈ ਕੋਈ ਵੀ ਚੀਜ਼ ਬਣਾਉਂਦੇ ਆਗੇ ਪਹਿਲਾਂ ਫਿਰ ਉਸ ਦੀ ਡਰਾਫਟਿੰਗ ਕਰਦੇ ਹਾਂ ਜਿੱਦਾਂ ਡਰਾਫਟਿੰਗ ਕਰਨ ਤੋਂ ਬਾਅਦ ਫਿਰ ਨਾਲ ਉਹਦੇ ਡਰਾਇੰਗ ਕਰਦੇ ਹਾਂ ਵੀ ਕਿਹੜੀ ਚੀਜ਼ ਬਣੀ ਹੈਗੀ ਫਿਰ ਉਸ ਦੀ ਉਸ ਦੀ ਅਸੀ ਡਰਾਇੰਗ ਕਰਕੇ ਦਿਖਾਉਂਦੇ ਆਗੇ ਵੀ ਇੱਦਾਂ ਇੱਦਾਂ ਬਣੀ ਆ ਜਿੱਦਾਂ ਕੋਈ ਫਰੋਕ ਵਗੈਰਾ ਬਣ ਗਈ ਫਿਰ ਉਸ ਦੀ ਡਰਾਫਟਿੰਗ ਕਰਦਿਆਂਗੇ ਫਿਰ ਨਾਲ ਡਰਾਇੰਗ ਕਰਦਿਆਂਗੇ ਅਤੇ ਉਸ ਨੂੰ ਮਤਲਬ ਕਿ ਵਧੀਆ ਤਰੀਕੇ ਨਾਲ ਬਣਾਉਂਦੇ ਆਗੇ ਵੀ ਦੇਖਣ ਵਾਲੇ ਨੂੰ ਥੋੜ੍ਹੀ ਜਿਹੀ ਵਧੀਆ ਲੱਗੇ ਜਿੱਦਾਂ ਕੋਈ ਸਲਵਾਰ ਸੂਟ ਹੋ ਗਿਆ ਫਿਰ ਉਸ ਦੀ ਡਰਾਫਟਿੰਗ ਕਰਦੇ ਹਾਂ ਡਰਾਫਟਿੰਗ ਕਰਨ ਤੋਂ ਬਾਅਦ ਫਿਰ ਉਸ ਦੀ ਡਰਾਇੰਗ ਕਰ ਦਿਆਂਗੇ ਅਤੇ ਇਸ ਤਰ੍ਹਾਂ ਅਲੱਗ ਅਲੱਗ ਤਰੀਕੇ ਨਾਲ ਮਤਲਬ ਵੀ ਅਸੀਂ ਆਪਣੀ ਡਰਾਇੰਗ ਕਰਕੇ ਦਿਖਾਉਂਦੇ ਆਗੇ